ਸਾਡੇ ਜਲੰਧਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਸੱਭਿਆਚਾਰਿਕ ਤਿਉਹਾਰ ਮਨਾਏ ਜਾਂਦੇ ਹਨ ਸੱਭਿਆਚਾਰਕ ਤਿਉਹਾਰਾਂ ਵਿੱਚੋਂ ਇੱਕ ਲੋੜੀ ਦਾ ਤਿਉਹਾਰ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਪੰਜਾਬ ਅਤੇ ਹਰਿਆਣੇ ਵਿੱਚ ਮਨਾਇਆ ਜਾਂਦਾ ਹੈ ਲੋੜੀ ਸੂਰਜ ਤੇ ਚਾਨਣ ਤੇ ਦਕਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ ਪਰ ਇਹ ਤੇਰਾ ਜਨਵਰੀ ਨੂੰ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਮਨਾਈ ਜਾਂਦੀ ਹੈ

ਜਿਹਦੇ ਵਿੱਚ ਲੜਕੇ ਹੋਣ ਦੀ ਖੁਸ਼ੀ ਚ ਪਿਓ ਉਸ ਲਈ ਲੋਹੜੀ ਮੰਗਦਾ ਹੈ ਇਹ ਇਸ ਲੋੜੀ ਵਿੱਚ ਸਭ ਤੋਂ ਜਿਆਦਾ ਜਿਆਦਾਤਰ ਘਰਾਂ ਵਿੱਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਵੀ ਬਣਾਈ ਜਾਂਦੀ ਹੈ ਤੇ ਜੇ ਕਿਸੇ ਮੁੰਡੇ ਦਾ ਵਿਆਹ ਹੋਇਆ ਜਾਵੇ ਤੇ ਉਹਦੀ ਖੁਸ਼ੀ ਵਿੱਚ ਲੋਕ ਰਿਸ਼ਤੇਦਾਰ ਨੱਚਦੇ ਹਨ ਟੱਪਦੇ ਹਨ ਬਹੁਤ ਖੁਸ਼ੀ ਮਨਾਉਂਦੇ ਹਨ ਅਤੇ ਮੂੰਗਫਲੀ ਰੇਵੜੀ ਬਹੁਤ ਖਾਂਦੇ ਵੀ ਹਨ ਇਹ ਹਰ ਘਰਾਂ ਦੇ ਵਿੱਚ ਲੋਹੜੀ ਮੰਗੀ ਜਾਂਦੀ ਹੈ ਜਿਹਦੇ ਵਿੱਚ ਕੁੜਈਆਂ ਦੇ ਵਿਆਹ ਕਰਵਾਏ ਜਾਂਦੇ ਸੀ ਪਹਿਲਾਂ ਦੁੱਲਾ ਭੱਟੀ ਨੇ ਦੋ ਕੁੜੀਆਂ ਦੇ ਵਿਆਹ ਕਰਵਾਏ ਸੀ ਜਿਹਦੇ ਵਿੱਚ ਇਹ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਵੀ ਮਨਾਏ ਗਏ ਇਸ ਲੀਏ ਲੋਹੜੀ ਦਾ ਤਿਉਹਾਰ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਵੇ ਦਿਨ ਬਹੁਤ ਲੋਕ ਖੁਸ਼ ਹੁੰਦੇ ਹਨ